ਪੰਜਾਬੀ ਸੱਭਿਆਚਾਰ ਦੇ ਵਿੱਚ ਰੰਗੋਲੀਆਂ ਨੂੰ ਲੋਕ ਆਪਣੇ ਤਿਉਹਾਰਾਂ ਦੇ ਵਿੱਚ ਘਰਾਂ ਦੇ ਵਿੱਚ ਰੰਗਾਂ ਦੇ ਨਾਲ਼ ਰੰਗੋਲੀਆਂ ਬਣਾਉਂਦੇ ਆ ਅਤੇ ਸੂਰਜ ਨੂੰ ਪਾਣੀ ਦੇਣਾ ਲੋਕ ਸੂਰਜ ਦੇਵਤਾ ਦੀ ਪੂਜਾ ਕਰਦੇ ਸਮੇਂ ਸਵੇਰ ਦੇ ਟਮੇ ਟਾਈਮ ਦੇ ਵਿੱਚ ਲੋਕ ਸੂਰਜ ਨੂੰ ਪਾਣੀ ਦਿੰਦੇ ਆ ਅਤੇ ਜਿਹੜੀ ਵਿਆਹੀ ਔਰਤ ਹੁੰਦੀ ਆ ਉਹ ਆਪਣੇ ਵਿਆਹ ਦੀ ਨਿਸ਼ਾਨੀ ਦੇ ਲਈ ਆਪਣੇ ਮੱਥੇ 'ਤੇ ਜੋ ਸੰਧੂਰ ਲਗਾਉਣ ਲਗਾਉਂਦੀ ਆ ਅਤੇ ਨਜ਼ਰ ਦੇ ਲਈ ਕਈ ਲੋਕ ਆਪਣੇ ਹੱਥਾਂ ਦੇ ਵਿੱਚ ਜਾਂ ਆਪਣੇ ਪੈਰਾਂ ਦੇ ਵਿੱਚ ਵੀ ਕਾਲ਼ਾ ਧਾਗਾ ਜੋ ਪਵਿੱਤਰ ਧਾਗਾ ਮੰਨਿਆ ਜਾਂਦਾ ਏ ਆ ਉਹ ਪਾਉਂਦੇ ਆ ਅਤੇ ਪੂਜਾ ਪਾਠ ਨੂੰ ਲੋਕ ਜ਼ਿਆਦਾ ਮਹੱਤਵ ਦਿੰਦੇ ਆ ਅਤੇ ਲੋਕ ਦਰਗਾਹਾਂ 'ਤੇ ਜਾਂਦੇ ਆ ਮੰਦਰ ਦੇ ਵਿੱਚ ਜਾ ਕੇ ਪੂਜਾ ਕਰਦੇ ਆ ਅਤੇ ਲੋਕ ਆਪਣੀ ਲੰਮੀ ਆਪਣੇ ਪਰਿਵਾਰ ਦੀ ਲੰਮੀ ਉਮਰ ਲਈ ਵਰਤ ਜਾਂ ਰੋਜ਼ੇ ਰੱਖਦੇ ਆ